ਸਿੱਖ ਰਾਜ ਦੀ ਤਿੰਨ ਸੌ ਸਾਲਾ ਵਰ੍ਹੇਗੰਢ 'ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਮੈਂ ਇੱਕ ਕਿਤਾਬ ਪੜ੍ਹੀ ਸੀ ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਹੀ ਅੱਛੀਆਂ ਗੱਲਾਂ ਲਿਖੀਆਂ ਹੋਈਆਂ ਸੀ ਜਿਸ ਵਿੱਚ ਲਿਖੀ ਇੱਕ ਲਾਈਨ ਮੇਰੇ ਮਨ ਨੂੰ ਬਹੁਤ ਪ੍ਰਭਾਵਿਤ ਕਰ ਗਈ ਤਵਾਰੀਖ ਨੇ ਅੱਖੀ ਤੱਕਿਆ ਇੱਕ ਅਨੋਖਾ ਮੰਜਰ ਬਿਜਲੀ ਅੱਗ ਤੂਫਾਨ ਅਤੇ ਲੋਹਾ ਇੱਕ ਬੰਦੇ ਅੰਦਰ ਮੈਂ ਚਾਹੁੰਦਾ ਹਾਂ ਇਸੇ ਤਰ੍ਹਾਂ ਵੀ ਹਰ ਜਗ੍ਹਾ ਹਰ ਮੈਦਾਨ ਫਤਿਹ ਕਰਨ ਵਾਸਤੇ ਸਾਨੂੰ ਵੀ ਆਪਣੇ ਆਪ 'ਚ ਇਹੋ ਜਿਹਾ ਜਜ਼ਬਾ ਪੈਦਾ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਕਿਸੇ ਵੀ ਮੁਸ਼ਕਿਲ ਸਮੇਂ ਵਿੱਚ ਨਾ ਡਰੀਏ ਹਰ ਜਗ੍ਹਾ ਜਿੱਤ ਹਾਸਲ ਕਰਨ ਵਾਸਤੇ ਅੱਗੇ ਵਧਦੇ ਰਹੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਪੁਸਤਕ ਬਹੁਤ ਹੀ ਵਧੀਆ ਸੀਗੀ ਜੋ ਕਿ ਮੇਰੇ ਮਨ ਨੂੰ ਬਹੁਤ ਜ਼ਿਆਦਾ ਭਾਅ ਗਈ ਅਗਰ ਆਪਾਂ ਆਪਣੇ ਮਨ ਨੂੰ ਜਿੱਤ ਲਵਾਂਗੇ ਤਾਂ ਆਪਾਂ ਇਹ ਸੰਸਾਰ ਨੂੰ ਆਸਾਨੀ ਨਾਲ ਜਿੱਤ ਸਕਦੇ ਹਾਂ ਅਤੇ ਸਾਨੂੰ ਆਪਣੇ ਆਪ 'ਤੇ ਪੂਰਨ ਵਿਸ਼ਵਾਸ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ